ਵਿਗਿਆਨਿਕ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਵਿਗਿਆਨੀ ਅਜਿਹੇ ਹੋਏ ਹਨ ਜਿਹਨਾਂ ਨੇ ਇੱਕ ਬਹੁਤ ਸ਼ਾਨਦਾਰ ਕੰਮ ਕੀਤਾ ਹੈ ਅਤੇ ਭਾਰਤ ਦਾ ਜਿਹੜਾ ਮਾਣ ਹੁੰਦਾ ਹੈਗਾ ਜੇ ਅਸੀਂ ਕਲਪਨਾ ਚਾਵਲਾ ਵੱਲ ਦੇਖੀਏ ਉਹਨਾਂ ਦੀ ਗੱਲ ਕਰੀਏ ਤਾਂ ਕਲਪਨਾ ਚਾਵਲਾ ਇੱਕ ਅਜਿਹੀ ਪਹਿਲੀ ਭਾਰਤੀ ਮਹਿਲਾ ਸੀ ਔਰਤ ਸੀ ਜਿਹੜੀ ਕਿ ਪਹਿਲੀ ਵਾਰ ਪਲਾਟ 'ਤੇ ਪਹੁੰਚੀ ਸੀ ਅਤੇ ਉੱਥੇ ਜਾ ਕੇ ਉਹਨੇ ਸਫਲਤਾ ਪੂਰਵਕ ਤਰੀਕੇ ਨਾਲ ਆਪਣਾ ਜਿਹੜਾ ਉੱਥੇ ਕੰਮ ਜਿਹੜਾ ਉਹ ਕੀਤਾ ਸੀ ਸੁਨੀਤਾ ਵਿਲੀਅਮਜ ਵੀ ਜਿਹੜੀ ਪਲਾਟ 'ਤੇ ਪਹੁੰਚਣ ਵਾਲੀ ਜਿਹੜੀ ਇੱਕ ਮਹਿਲਾ ਵਜੋਂ ਗਿਣੀ ਜਾਂਦੀ ਹੈ ਤਾਂ ਇਹਨਾਂ ਨੇ ਇੱਕ ਔਰਤ ਹੋ ਕੇ ਵਿਗਿਆਨਿਕ ਖੇਤਰ ਦੇ ਵਿੱਚ ਕਿਵੇਂ ਔਰਤਾਂ ਤਰੱਕੀ ਕਰ ਸਕਦੀਆਂ ਹਨ ਜਾਂ ਔਰਤਾਂ ਹਰ ਖੇਤਰ ਦੇ ਵਿੱਚ ਆਪਣੇ ਜਿਹੜੇ ਪੈਰ ਆਪਣੇ ਪਸ ਪਸਾਰ ਰਹੀਆਂ ਹਨ ਤਾਂ ਹਰ ਖੇਤਰ ਦੇ ਵਿੱਚ ਉਹ ਤਰੱਕੀ ਕਰ ਰਹੀਆਂ ਹਨ ਕੋਈ ਵੀ ਕੋਈ ਵੀ ਖੇਤਰ ਹੋਵੇ ਉੱਥੇ ਕੁੜੀਆਂ ਨੇ ਬਹੁਤ ਮੱਲਾਂ ਮਾਰੀਆਂ ਹਨ ਅਤੇ ਭਾਵੇਂ ਉਹ ਪੁਲਾੜ ਖੇਤਰ ਹੋਏ ਭਾਵੇਂ ਵਿਗਿਆਨ ਹੋਵੇ ਭਾਵੇਂ ਸਾਡੇ ਦੂਜੇ ਸਿਹਤ ਨਾਲ ਸੰਬੰਧਿਤ ਸਿੱਖਿਆ ਨਾਲ ਸੰਬੰਧਿਤ ਕੋਈ ਵੀ ਖੇਤਰ ਹਰੇਕ ਖੇਤਰ ਦੇ ਵਿੱਚ ਔਰਤਾਂ ਜਿਹੜੀਆਂ ਉਹ ਆਪਣੇ ਕੰਮ ਕਰ ਰਹੀਆਂ ਹਨ ਅਤੇ ਭਾਰਤ ਦਾ ਮਾਣ ਵਧਾ ਰਹੀਆਂ ਹਨ